ਹਾਂ ਮੈਂ ਡਿਜੀਟਲ ਪੇਂਟਿੰਗ ਕਰਦੀ ਹਾਂ ਮੈਨੂੰ ਡਿਜੀਟਲ ਪੇਂਟਿੰਗ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਂ ਇਹ ਡਿਜੀਟਲ ਪੇਂਟਿੰਗ ਡਰਾਇੰਗ ਐਪ 'ਤੇ ਕਰਦੀ ਹਾਂ ਡਿਜੀਟਲ ਪੇਂਟਿੰਗ ਅਤੇ ਟ੍ਰੈਡੀਟੀਅਮ ਪੇਂਟਿੰਗ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਡਿਜੀਟਲ ਪੇਂਟਿੰਗ ਪਿਛਲੇ ਹੀ ਦਿਨ ਜਦੋਂ ਥਰੀ ਡੀ ਗ੍ਰਾਫਿਕਸ ਹੋਣੇ ਵਿਕਸਿਤ ਹੋਏ ਸੀ ਜਦੋਂ ਗ੍ਰਾਫਿਕਸ ਵਿਕਸਿਤ ਹੋਣੇ ਸ਼ੁਰੂ ਹੀ ਹੋਏ ਸੀ ਹੀ ਅਤੇ ਥਰੀ ਡੀ ਮਿਆਰ ਹੁਣੇ ਆਕਾਰ ਦੇ ਰਹੇ ਸੀ ਇਹ ਟੈਕਸਟ ਸਿਰਫ਼ ਇੱਕ ਪ੍ਰਿੰਟ ਕੀਤੇ ਯੂ ਵੀ ਨਕਸ਼ੇ 'ਤੇ ਡਰਾਇੰਗ ਦੁਬਾਰਾ ਕੀਤੀ ਜਾਂਦੀ ਸੀ ਇਸ ਲਈ ਵੱਖ ਵੱਖ ਕਾਰਟੂਨਾਂ ਦੇ ਲਈ ਬਹੁਤ ਸਾਰੇ ਟੈਕਸਟ ਬਣਾਏ ਜਾਂਦੇ ਸੀ ਹਾਲਾਂਕਿ ਬਹੁਤ ਸਾਰੇ ਸੰਵਿਧਾਨ ਸੀ ਆਸੁਵਿਧਾਜਨਕ ਅਤੇ ਗੁੰਜਲਦਾਰ ਸੀ ਇਹ ਇਸ ਲਈ ਅੱਜ ਵੀ ਕਿਸੇ ਵੀ ਥਰੀ ਡੀ ਸੰਪਾਦਨ ਕੋਲ ਥਰੀ ਡੀ ਮਾਡਲ ਅਤੇ ਹੈਂਡ ਪੇਂਟਿੰਗ ਦਾ ਕੰਮ ਹੁੰਦਾ ਹੈ ਇਹ ਸਿਧਾਂਤ ਨਾਲ ਬਹੁਤ ਸਾਰਾ ਕੰਮ ਕਰਨਾ ਜਿਹੜਾ ਸੌਖਾ ਹੋ ਗਿਆ ਸੀ ਕਿਉਂਕਿ ਇਸ ਮਾਡਲ ਲਈ ਟੈਕਸਟ ਬਣਾਉਣ ਲਈ ਸਾਨੂੰ ਨੂੰ ਦੋ ਡੀ ਵੀ ਗ੍ਰਾਫਿਕਸ ਐਡੀਟਰਾਂ ਦੀ ਲੋੜ ਵੀ ਸੀ ਇਸ ਲਈ ਥਰੀ ਡੀ ਅਤੇ ਟ੍ਰੈਡੀਟਨਲ ਪੇਂਟਿੰਗ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ